ਮੋਹਾਲੀ ਜ਼ਿਲ੍ਹੇ ਦਾ ਇਤਿਹਾਸ ਮੋਹਾਲੀ ਜ਼ਿਲ੍ਹੇ ਦੇ ਇਤਿਹਾਸਿਕ ਪਿੰਡ ਚੱਪੜਚਿੜੀ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸੂਬਾ ਸਰਹੰਦ ਵਜ਼ੀਰ ਖਾਂ ਜਿਹਨੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕੀਤਾ ਗਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਦੱਖਣ ਤੋਂ ਥਾਪੜਾ ਲੈ ਕੇ ਸੰਢੋਰੇ ਆ ਕੇ ਪਹਿਲਾਂ ਗੁਰੂ ਕੀ ਫੌਜ ਇਕੱਠੀ ਕੀਤੀ ਉਸ ਤੋਂ ਬਾਅਦ ਚੱਪੜਚਿੜੀ ਦੇ ਜੰਗ ਦੇ ਮੈਦਾਨ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਵਜ਼ੀਰ ਖਾਂ ਅਤੇ ਉਹਦੀ ਫੌਜ ਨੂੰ ਹਰਾਇਆ ਉੱਥੇ ਤੋਂ ਹੀ ਘੋੜਿਆਂ ਨਾਲ਼ ਬੰਨ੍ਹ ਕੇ ਸਰਹੰਦ ਲੈ ਕੇ ਗਏ ਜਿੱਥੇ ਜਿੱਥੇ ਤੱਕ ਵਜ਼ੀਰ ਖਾਂ ਨੂੰ ਘੋੜਿਆਂ ਦੇ ਪਿੱਛੇ ਘੜੀਸਿਆ ਗਿਆ ਅੱਜ ਉੱਥੇ ਤੱਕ ਹੀ ਸਰਹੰਦ ਵਸੀ ਹੋਈ ਹੈ ਅੱਜ ਉਹਨਾਂ ਦੀ ਯਾਦ ਦੇ ਵਿੱਚ ਬਾਬਾ ਬੰਦਾ ਸਿੰਘ ਦੀ ਯਾਦ ਦੇ ਵਿੱਚ ਚੱਪੜਚਿੜੀ ਇਤਿਹਾਸਿਕ ਗੁਰਦੁਆਰਾ ਸਾਹਿਬ ਵੀ ਹੈ ਅਤੇ ਮੌਜੂਦਾ ਸਰਕਾਰ ਵੱਲੋਂ ਉਸ ਟਾਈਮ ਉੱਥੇ ਇੱਕ ਅਜੂਬਾ ਬਣਾਇਆ ਗਿਆ ਸੀ ਜੋ ਅੱਜ ਵੀ ਉੱਥੇ ਮੌਜੂਦ ਹੈ ਮੋਹਾਲੀ ਦੇ ਜਿੰਨੇ ਵੀ ਪਰਿਵਾਰ ਹੈ ਸਮੂਹ ਪਰਿਵਾਰ ਹੈ ਉਹ ਸਾਰੇ ਉਹ ਅਜੂਬੇ ਦੇ ਦਰਸ਼ਨ ਕਰਨ ਜਾਂਦੇ ਨੇ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ਼ ਸਿੰਘ ਸਨ ਉਸ ਟਾਈਮ ਦੇ ਪੰਜ ਸਿੰਘ ਆਏ ਸੀ ਦੱਖਣ ਤੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭੇਜੇ ਸੀਗੇ ਉਹਨਾਂ ਦੇ ਉੱਥੇ ਅੱਜ ਬੁੱਤ ਲੱਗੇ ਹੋਏ ਐਂ ਔਰ ਇੱਕ ਸੱਭਿਆਚਾਰਕ ਮਹੱਤਤਾ ਮੋਹਾਲੀ ਇਲਾਕੇ ਦੀ ਇਹ ਹੈ ਕਿ ਜੀ ਇੱਥੇ ਪੁਆਧੀ ਦਾ ਜਨਮ ਹੋਇਆ ਪੁਆਧ ਇਲਾਕਾ ਇੱਧਰ ਪਟਿਆਲੇ ਤੱਕ ਜੀਂਦ ਹੰਸਾਰ ਇੱਧਰ ਅਨੰਦਪੁਰ ਸਾਹਿਬ ਤੱਕ ਅੰਬਾਲੇ ਤੱਕ ਇਹ ਸਾਰਾ ਪੁਆਧੀ ਇਲਾਕਾ ਸੀਗਾ ਇਹਦੇ ਵਿੱਚ ਸਭ ਤੋਂ ਬੜੀ ਬਖਸ਼ਿਸ਼ ਇਸ ਮੋਹਾਲੀ ਧਰਤੀ ਨੂੰ ਇਹੀ ਹੈ ਵੀ ਪੁਆਧ ਦੇ ਇਲਾਕੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਟਾਈਮ ਆਨੰਦਪੁਰ ਸਾਹਿਬ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਖਾਲਸੇ ਪੰਥ ਦੀ ਸਾਜਨਾ ਕੀਤੀ ਸੀਗੀ ਹੋਰ ਇਤਿਹਾਸਿਕ ਪੱਖ ਰਹੱਸਮਈ ਸਥਾਨ ਇੱਥੇ ਪੁਰਾਤਨ ਅਸਥਾਨ ਹੁਣ ਬਚੇ ਨਹੀਂ ਹਨ ਜੋ ਕਿ ਮੌਜੂਦਾ ਸਰਕਾਰ ਨੇ ਢਾਹ ਢੇਰੀ ਕਰਤੇ ਇਸ ਲਈ ਦੇਖਣਯੋਗ ਉੱਥੇ ਜਗ੍ਹਾਵਾਂ ਦਾਰਾ ਸਟੂਡੀਓ ਰੁਸਤਮ ਏ ਹਿੰਦ ਦਾਰਾ ਹਿੰਦ ਕੇਸਰੀ ਜਿਹਨੂੰ ਪਹਿਲਵਾਨ ਵਜੋਂ ਆਪਣਾ ਭਾਰਤ ਦੇਸ਼ ਅੱਜ ਵੀ ਯਾਦ ਕਰਦਾ ਦਾਰਾ ਸਿੰਘ ਉਹਨਾਂ ਦੀ ਯਾਦ ਵਿੱਚ ਮਿਊਜਿਅਮ ਬਣਿਆ ਹੋਇਆ ਦਾਰਾ ਸਟੂਡੀਓ ਵੇਰਕਾ ਏ ਸਰਕਾਰੀ ਡਿਪਾਰਟਮੈਂਟ ਜੋ ਕਿ ਬਹੁਤ ਮਸ਼ਹੂਰ ਹੈ ਉਸ ਤੋਂ ਅੱਗੇ ਕੋਲਜ ਇਹ ਵੀ ਬਹੁਤ ਪੁਰਾਣਾ ਕੋਲਜ ਹੈ ਸਰਕਾਰੀ ਕੋਲਜ ਆ ਉਹਦੇ ਨਾਲ਼ੇ ਹੋਸਪੀਟਲ ਏ ਇਹ ਚੀਜ਼ਾਂ ਮੋਹਾਲੀ ਦੀਆਂ ਸ਼ਾਨ ਵਧਾਉਂਦੀਆਂ